ਵੈਸੇ ਤਾਂ ਭਾਰਤ ਵਿੱਚ ਆਵਾਜਾਈ ਦੇ ਸਾਧਨ ਲੋਕਾਂ ਕੋਲ ਆਪਣੇ ਆਪਣੇ ਹਨ ਹਰ ਇੱਕ ਨੇ ਆਪਣਾ ਆਪਣਾ ਹਾ ਸਾਧਨ ਲਿਤਾ ਹੋਇਆ ਹੈ ਬਟ ਕੁਛ ਜਿਹੜੇ ਗਰੀਬ ਲੋਕ ਹਨ ਜਿਹਨਾਂ ਨੂੰ ਆ ਬੱਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਟੈਂਪੂਆਂ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਵੀ ਜਾਣ ਆਉਣ ਲਈ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਤੇ ਉਹੀ ਬੜਾ ਹੀ ਗੰਦਾ ਚੱਲ ਰਿਹਾ ਅੱਜ ਕੱਲ੍ਹ ਪ ਭਾਰਤ ਵਿੱਚ ਕਿਉਂਕਿ ਨਾ ਤਾਂ ਟਾਈਮ ਸਿਰ ਕੋਈ ਬੱਸ ਆਉਂਦੀ ਆ ਨਾ ਟਾਈਮ ਸਿਰ ਕੋਈ ਆਟੋ ਆਉਂਦਾ ਲੋਕਾਂ ਨੂੰ ਦੋ ਦੋ ਘੰਟੇ ਅੱਡਿਆਂ ਦੇ ਖੜ੍ਹ ਕੇ ਵੇਟ ਕਰਨੀ ਪੈਂਦੀ ਐ ਤੇ ਜਿਹੜੀਆਂ ਸੜਕਾਂ ਉਹ ਵੀ ਬਹੁਤ ਟੁੱਟੀਆਂ ਹੋਈਆਂ ਹਨ ਅਤੇ ਲੋਕ ਘੁੰਮ ਫਿਰ ਕੇ ਹੋਰ ਹੋਰ ਪਿੰਡਾਂ 'ਚ ਨੂੰ ਹੋ ਕੇ ਜਾਂਦੇ ਹਨ ਬਿਕੋਜ਼ ਉਸ ਸੜਕਾਂ ਕਰਕੇ ਜੇ ਸਰਕਾਰ ਨੂੰ ਮੈਂ ਅਪੀਲ ਕਰਨੀ ਚਾਹੁੰਦੀ ਹਾਂ ਇੱਕ ਤਾਂ ਟਾਈਮ ਟੂ ਟਾਈਮ ਬਸ ਸਰਵਿਸ ਕਰ ਦਿੱਤੀ ਜਾਵੇ ਹੈ ਨਾ ਅਤੇ ਜਿਹੜੀਆਂ ਸੜਕਾਂ ਹਨ ਸਾਰੇ ਏਰੀਏ ਦੀਆਂ ਬਹੁਤ ਵਧੀਆ ਤਰੀਕੇ ਨਾਲ ਬਣਾ ਦੇਣੀਆਂ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਨੇ ਟਰੈਵਲ ਕਰਕੇ ਕਿਸੇ ਹੋਰ ਸਾਧਨ 'ਤੇ ਜਾਣਾ ਉਹ ਬੜਾ ਈਜ਼ੀਲੀ ਅਤੇ ਜਲਦੀ ਟਾਈਮ ਸਿਰ ਪਹੁੰਚ ਸਕੇ ਕਿਉਂਕਿ ਹਰ ਇੱਕ ਨੇ ਆ ਕੇ ਆਪਣਾ ਘਰ ਵੀ ਦੁਬਾਰਾ ਦੇਖਣਾ ਹੁੰਦਾ ਏ ਹੈ ਨਾ ਅਤੇ ਕਈ ਵਾਰ ਐਮਰਜੈਂਸੀ ਹੁੰਦੀ ਆ ਗਰੀਬ ਕੋਲੇ ਕਿ ਜਿਹਨੇ ਹੋਸਪਿਟਲ ਜਾਣਾ ਭੱਜ ਕੇ ਕਿਸੇ ਦਾ ਐਕਸੀਡੈਂਟ ਹੋ ਗਿਆ ਕੁਛ ਵੀ ਨਾ ਅਤੇ ਉਹਨੂੰ ਵੀ ਘੱਟੋ ਘੱਟ ਜੇ ਪੰਜ ਮਿੰਟ ਦੀ ਦੂਰੀ 'ਤੇ ਵੀ ਜਾਣਾ ਨਾ ਤਾਂ ਉਹਨੂੰ ਵੀ ਪੰਦਰਾਂ ਮਿੰਟ ਚਲ ਲੱਗ ਜਾਂਦੇ ਹਨ ਕਿਉਂਕਿ ਅੱਜ ਕੱਲ੍ਹ ਜਿਹੜੀ ਆਵਾਜਾਈ ਦੇ ਸਾਧਨ ਲੋਕਾਂ ਕੋਲ ਆਪਣੇ ਹੋ ਗਏ ਹਨ ਅਤੇ ਉਹ ਰਸਤਾ ਹੀ ਨਹੀਂ ਦਿੰਦੇ ਕਿਸੇ ਨੂੰ ਅਤੇ ਉਹ ਬੱਸਾਂ ਵਗੈਰਾ ਤੋਂ ਕੁਝ ਸਮਝਦੇ ਹੀ ਨਹੀਂ ਹੈਗੇ ਅਤੇ ਪਲੀਜ਼ ਕਿਰਪਾ ਕਰਕੇ ਮੋਸਟਲੀ ਜਿਹੜਾ ਇਕੱਲਾ ਬੰਦਾ ਉਹਨੂੰ ਤਾਂ ਬੱਸ ਹੀ ਪ੍ਰੈਫਰ ਕਰੀ ਜਾਵੇ ਸਰਕਾਰ ਵੱਲੋਂ ਹਰ ਇੱਕ ਚੀਜ਼ ਦੇ ਅਲਾਊਡੈਂਸ ਦਿੱਤੀ ਜਾਵੇ